ਹਾਂਜੀ ਸਾਡੇ ਪਿੰਡ ਦੇ ਵਿੱਚ ਟਰਾਈਡੈਂਟ ਜੋ ਗਰੁੱਪ ਦੀ ਕੰਪਨੀ ਹੈ ਬੜੀ ਨਾਮਵਰ ਇਕ ਪ੍ਰਸਿੱਧ ਕੰਪਨੀ ਹੈ ਉਸਨੇ ਸਭ ਤੋਂ ਵੱਧ ਜੋ ਹੈ ਸਾਡੇ ਪਿੰਡ ਦੇ ਅਤੇ ਹੋਰ ਪ੍ਰਵਾਸੀ ਲੋਕਾਂ ਨੂੰ ਜੋ ਹੈ ਕੰਮ ਪ੍ਰਦਾਨ ਕੀਤਾ ਹੋਇਆ ਹੈ ਇੱਥੇ ਵੱਖ ਵੱਖ ਪਲਾਂ ਤਰ੍ਹਾਂ ਦੇ ਪਲਾਂਟ ਹੋਣ ਦੇ ਕਾਰਨ ਵੱਖ ਵੱਖ ਜਿਹੜੇ ਕੰਮ ਨੇ ਉਹ ਲੋਕਾਂ ਨੂੰ ਪ੍ਰਦਾਨ ਕੀਤੇ ਗਏ ਹਨ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਇਥੇ ਲੋਕ ਜਿਹੜੇ ਨਿਭਾ ਰਹੇ ਨੇ ਜਿਆਦਾਤਰ ਜੋ ਪ੍ਰਵਾਸੀ ਹਨ ਉਹ ਉੱਤਰ ਪ੍ਰਦੇਸ਼ ਜਾਂ ਬਿਹਾਰ ਆਦਿ ਰਾਜਾਂ ਤੋਂ ਐਥੇ ਆ ਕੇ ਪਰਵਾਸ ਕਰ ਰਹੇ ਨੇ ਅਤੇ ਉਹਨਾਂ ਵਿੱਚੋਂ ਜਿਆਦਾਤਰ ਜੋ ਪ੍ਰਵਾਸੀ ਹਨ ਬਾਹਰੋਂ ਆਏ ਹਨ ਜਾਂ ਲੋਕਲ ਸਥਾਨਕ ਕਰਮਚਾਰੀ ਨੇ ਉਹ ਜਿਆਦਾਤਰ ਪੈਕਿੰਗ ਦੀਆਂ ਸੇਵਾਵਾਂ ਨਿਭਾ ਰਹੇ ਹਨ

ਜਿਆਦਾਤਰ ਇੱਥੇ ਪਹਿਲਾਂ ਵੀ ਦੱਸਿਆ ਗਿਆ ਹੈ ਵੀ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਵਿੱਚੋਂ ਆਕੇ ਲੋਕ ਪ੍ਰਵਾਸ ਉਹਨਾਂ ਨੇ ਕੀਤਾ ਹੈ ਅਤੇ ਜ਼ਿਆਦਾਤਰ ਉਹ ਪੈਕਿੰਗ ਦੀਆਂ ਸੇਵਾਵਾਂ ਇਥੇ ਨਿਭਾਅ ਰਹੇ ਹਨ ਧੰਨਵਾਦ ਜੀ